ਹਾਂ ਮੈਂ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਸਹਿਪਾਠੀਆਂ ਦੇ ਨਾਲ ਤਸਵੀਰਾਂ ਲੈਣ ਲਈ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕੀਤੀ ਇਹ ਯਾਤਰਾ ਅਸੀਂ ਸੋਲਨ ਸ਼ਹਿਰ ਅਤੇ ਹੋਰ ਨਾਲ ਦੇ ਸ਼ਹਿਰਾਂ ਵਿੱਚ ਕੀਤੀ ਅਸੀਂ ਸੱਤ ਅੱਠ ਮਿੱਤਰ ਤਸਵੀਰਾਂ ਲੈਣ ਲਈ ਇੱਕ ਹਿਮਾਚਲ ਪ੍ਰਦੇਸ਼ ਵਿੱਚ ਸੋਲਨ ਸ਼ਹਿਰ ਦੇ ਬਹੁਤ ਹੀ ਖੂਬਸੂਰਤ ਖੇਤਰ ਵਿੱਚ ਗਏ ਜਿੱਥੇ ਕਿ ਕੁਦਰਤ ਸ ਦੀ ਇੰਨੀ ਸੁੰਦਰਤਾ ਦੇਖ ਕੇ ਅਸੀਂ ਬਹੁਤ ਪ੍ਰਸੰਨ ਹੋਏ ਇਹ ਤਸਵੀਰਾਂ ਸਾਡੇ ਲਈ ਬਹੁਤ ਹੀ ਖਾਸ ਸਨ ਕੁਦਰਤ ਅਜਿਹੀ ਛਾਪ ਛੱਡ ਰਹੀ ਸੀ ਮਾਨੋ ਕਿ ਰੱਬ ਨੀਚੇ ਆਇਆ ਹੋਵੇ ਮੈਂ ਭਾਰਤ ਦੇ ਅਜਿਹੇ ਸਥਾਨਾਂ 'ਤੇ ਫੋਟੋਆਂ ਲੈਣਾ ਚਾਹੁੰਦਾ ਹਾਂ ਜਿੱਥੇ ਕੁਦਰਤ ਦੀ ਅਨੋਖੀ ਛਾਪ ਹੋਵੇ ਮੈਂ ਕੁਝ ਧਾਰਮਿਕ ਸਥਾਨਾਂ 'ਤੇ ਵੀ ਫੋਟੋਆਂ ਲੈਣਾ ਚਾਹੁੰਦਾ ਹਾ ਜੋ ਕਿ ਭਾਰਤ ਦੇ ਵਿੱਚ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹੋਣ